ਖੇਡਾਂ ਲੋਕਾਂ ਲਈ ਸਟਰੈੱਸ ਰਹਿਤ ਇਸ ਲਈ ਹੈ ਕਿਉਂਕਿ ਜਦੋਂ ਅਸੀਂ ਕਦੇ ਵੀ ਖੇਡਦੇ ਹਾਂ ਤਾਂ ਅਸੀਂ ਖੇਡ ਖੇਡ ਵਿੱਚ ਇਹ ਭੁੱਲ ਜਾਂਦੇ ਹਾਂ ਸਾਨੂੰ ਕੀ ਗੱਲ ਦਾ ਕਿਸ ਗੱਲ ਦਾ ਸਟਰੈੱਸ ਸੀ ਜਦੋਂ ਮੈਨੂੰ ਵੀ ਕਦੇ ਸਟਰੈੱਸ ਹੁੰਦਾ ਹੈ ਤਾਂ ਮੈਂ ਆਪਣਾ ਧਿਆਨ ਆ ਜੋ ਕਿ ਖੇਡਾਂ ਵਿੱਚ ਲਗਾ ਲਾ ਜਿਵੇਂ ਕਿ ਲੂਡੋ ਹੋ ਗਿਆ ਜਾਂ ਘਰ ਦੇ ਬਾਹਰ ਕੋਈ ਬੱਚੇ ਹੁੰਦੇ ਆ ਉਹਨਾਂ ਨਾਲ ਖੇਡਣ ਲੱਗ ਜਾਂਦੀ ਹਾਂ ਕਿਉਂਕਿ ਉਹਨਾਂ ਨਾਲ ਖੇਡਦੇ ਖੇਡਦੇ ਇੱਕ ਤਾਂ ਉਹਨਾਂ ਨਾਲ ਖੇਡਣ ਦਾ ਟਾਈਮ ਟਾਈਮ ਲੱਗ ਜਾਂਦਾ ਹੈ ਅਤੇ ਦਿਮਾਗ 'ਚ ਵੀ ਭੁੱਲ ਜਾਂਦਾ ਹੈ ਕਿ ਆਪਾਂ ਨੂੰ ਸਟਰੈੱਸ ਕਿਸ ਗੱਲ ਦਾ ਸੀ ਅਤੇ ਲੋਕਾਂ ਨੂੰ ਜ਼ਿਆਦੇ ਕਰਕੇ ਖੇਡਣਾ ਚਾਹੀਦਾ ਅਤੇ ਉਹ ਖੇਡਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੀਦਾ ਕਿਤੇ ਕੋਈ ਕੈਂਪ ਲੱਗਿਆ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕੋਈ ਕੋਈ ਫੰਕ ਫੰਕਸ਼ਨ ਹੁੰਦਾ ਉੱਥੇ ਵੀ ਕਈ ਵੇਲੇ ਬੋਲ ਦਿੰਦੇ ਵੀ ਖੇਡਦਾ ਏ ਕੋਂਪੀਟੀਸ਼ਨਜ਼ ਹੁੰਦੇ ਹੈ ਉਹ ਸਾਨੂੰ ਕਦੇ ਵੀ ਨਹੀਂ ਛੱਡਣੇ ਚਾਹੀਦੇ ਜੋ ਕਿ ਹੁੰਦੇ ਖੇਡਾਂ ਦੇ ਰਿਲੇਟਡ ਖੇਡਾਂ ਸਾਨੂੰ ਖੇਡਦੇ ਰਹਿਣਾ ਚਾਹੀਦਾ ਹੈ ਖੇਡਣ ਵਾਲਾ ਵਿਅਕਤੀ ਨੂੰ ਕੋਈ ਸਟਰੈੱਸ ਨਹੀਂ ਹੁੰਦਾ ਉਹ ਸਟਰੈੱਸ ਫਰੀ ਰਹਿਤ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਸਟਰੈੱਸ ਵਿੱਚ ਰਹਿੰਦੇ ਹੈ ਤਾਂ ਕਈ ਵੇਲੇ ਆਪਣੀ ਜਾਨ ਨੂੰ ਨੁਕਸਾਨ ਹੋ ਜਾਂਦਾ ਹੈ ਪਰ ਜਦੋਂ ਆਪਾਂ ਉਸ ਉਸ ਨੁਕਸਾਨ ਨੂੰ ਬਚਾਉਣ ਲਈ ਆਪਾਂ ਖੇਡਦੇ ਹਾਂ ਕਿਉਂਕਿ ਸਟਰੈੱਸ ਆਪਣੇ ਲਈ ਇੱਕ ਜਾਨ ਲਈ ਵੀ ਖਤਰਾ ਹੈ ਜੇ ਆਪਾਂ ਸਟਰੈੱਸ ਰਹਿਤ ਰਹਿਣਾ ਹੋਵੇ ਤਾਂ ਸਾਨੂੰ ਖੇਡਦੇ ਰਹਿਣਾ ਚਾਹੀਦਾ ਹਰੇਕ ਵਿਅਕਤੀ ਨੂੰ ਖੇਡਣਾ ਬਹੁਤ ਜ਼ਰੂਰੀ ਹੈ ਜ਼ਿਆਦਾ ਕਰਕੇ ਸਭ ਤੋਂ ਛੋਟੇ ਬੱਚੇ ਨੂੰ ਇਹ ਜ਼ਰੂਰੀ ਨਹੀਂ ਕਿ ਖੇਡ ਸਿਰਫ ਛੋਟਾ ਵਿਅਕਤੀ ਹੀ ਖੇਡ ਸਕਦਾ ਏ ਬੜਾ ਨਹੀਂ ਖੇਡਦਾ ਇਹ ਕੋਈ ਵੀ ਉਮਰ ਦਾ ਵਿਅਕਤੀ ਖੇਡ ਸਕਦਾ ਹੈ ਖੇਡਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਵੀ ਉਹ ਹਰੇਕ ਖੇਡ ਵਿੱਚ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਜਿਹੜੇ ਖੇਡ ਨਹੀਂ ਖੇਡਦੇ ਵੀ ਇਹ ਖੇਡ ਖੇਡਣ ਨਾਲ ਵੀ ਸਟਰੈੱਸ ਰਹਿਤ ਰਹਿੰਦਾ ਹੈ ਕਿਉਂਕਿ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਖੇਡਦੇ ਹਾਂ ਤਾਂ ਉਸ ਨਾਲ ਸਾਨੂੰ ਸਟਰੈੱਸ ਨਹੀਂ ਹੁੰਦਾ ਅਤੇ ਦੂਜੀ ਗੱਲ ਇਸ ਟਾਇਮ ਜਿਹੜਾ ਗੇਮ ਖੇਡਣ ਵਾਲਾ ਵਿਅਕਤੀ ਹਮੇਸ਼ਾਂ ਤੰਦਰੁਸਤ ਔਰ ਹਸਮੁਖ ਹੁੰਦਾ ਹੈ